ਮੈਂ ਆਪਣੇ ਬੱਚਿਆਂ ਨੂੰ ਬੈਂਕਿੰਗ ਖੇਤਰ ਵਿੱਚ ਕੈਰੀਅਰ ਨੂੰ ਤਰਜੀਹ ਜ਼ਰੂਰ ਦੇਵਾਂਗੀ ਕਿਉਂਕਿ ਜਿਹੜਾ ਬੈਂਕ ਦਾ ਖੇਤਰ ਆ ਉਹ ਬਹੁਤ ਵਧੀਆ ਵਾ ਇਸ ਵਿੱਚ ਬਹੁਤ ਵਧੀਆ ਅੱਗੇ ਉਹਨਾਂ ਦੀ ਜ਼ਿੰਦਗੀ ਵੀ ਜਿਹੜੀ ਆ ਉਹ ਬਹੁਤ ਵਧੀਆ ਬਣ ਜਾਂਦੀ ਆ ਜੇ ਉਹ ਬੈਂਕ ਵਿੱਚ ਨੌਕਰੀ ਕਰਨ ਅਤੇ ਆਪਣੇ ਕਿ ਜਿਵੇਂ ਇੱਥੇ ਬੈਂਕ ਬਹੁਤ ਵਧੀਆ ਨੇ ਅਤੇ ਬਹੁਤ ਵੱਖਰੇ ਵੱਖਰੇ ਤਰ੍ਹਾਂ ਦੇ ਬੈਂਕ ਨੇ ਜਿਵੇਂ ਇੰਡਸਲੈਂਡ ਬੈਂਕ ਓਵਰਸੀਜ਼ ਬੈਂਕ ਐੱਸ ਬੀ ਆਈ ਬੈਂਕ ਐੱਚ ਡੀ ਐੱਫ ਸੀ ਬੈਂਕ ਇਹਨਾਂ ਸਾਰਿਆਂ ਬੈਂਕਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜਾ ਵਾ ਉਹ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਅਤੇ ਫਿਰ ਇਹ ਬੈਂਕ ਜਿਹੜੇ ਨੇ ਇਹਨਾਂ ਦੇ ਵਿੱਚ ਆਮਦਨ ਵੀ ਬਹੁਤ ਵਧੀਆ ਹੁੰਦੀ ਆ ਅਤੇ ਜ਼ਿਆਦਾ ਹੁੰਦੀ ਆ ਆਮਦਨ ਵੀ ਅਤੇ ਮੈਂ ਆਪਣੇ ਬੱਚਿਆਂ ਨੂੰ ਇਹੋ ਭੂਮਿਕਾ ਦੇਵਾਂਗੀ ਕਿ ਉਹ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਇਹਦੀਆਂ ਕੋਚਿੰਗ ਕਲਾਸਾਂ ਵੀ ਲੈਣ ਜਿਹਦੇ ਨਾਲ ਉਹ ਸ਼ੁਰੂ ਤੋਂ ਹੀ ਇਸ ਖੇਤਰ ਦੇ ਨਾਲ ਜੁੜ ਸਕਣ ਅਤੇ ਕਿਉਂਕਿ ਇਹ ਖੇਤਰ ਬਹੁਤ ਵਧੀਆ ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਇਸੇ ਖੇਤਰ ਵਿੱਚ ਪਾਉਣਾ ਚਾਹੂੰਗੀ